ਕਾਰਤਿਕ ਪੂਰਨਿਮਾ ਦਾ ਤਾਂ ਮਹੱਤਵ ਬਹੁਤ ਹੀ ਜ਼ਿਆਦਾ ਪੰਜਾਬ ਦੇ ਵਿੱਚ ਕਾਰਤਿਕ ਪੂਰਨਿਮਾ ਦੇ ਵਿੱਚ ਵਰਿੰਦਾਵਣ 'ਚ ਤਾਂ ਬਹੁਤ ਹੀ ਜ਼ਿਆਦਾ ਤਾਦਾਦ ਦੇ ਨਾਲ ਸ਼ਰਧਾਲੂ ਆਉਂਦੇ ਹਨ ਉੱਥੇ ਤਾਂ ਬਹੁਤ ਹੀ ਮੇਲਾ ਲੱਗਿਆ ਹੁੰਦਾ ਹੈ ਉੱਥੇ ਤਾਂ ਇੰਨਾ ਜ਼ਿਆਦਾ ਰਸ਼ ਹੁੰਦਾ ਕਿ ਅਸੀਂ ਅਤੇ ਉੱਥੇ ਤਾਂ ਕਈ ਵਾਰ ਇਸ ਤਰ੍ਹਾਂ ਦਾ ਹਾਲ ਹੋ ਜਾਂਦਾ ਕਿ ਕਈ ਵਾਰੀ ਸਾਨੂੰ ਕਮਰਾ ਵੀ ਨਹੀਂ ਮਿਲਦਾ ਇੰਨਾ ਜ਼ਿਆਦਾ ਰਸ਼ ਹੁੰਦਾ ਕਾਰਤਿਕ ਪੂਰਨਿਮਾ ਰਾਮਲੀਲਾ ਦੇ ਵਿੱਚ ਰਾਮ ਚੰਦਰ ਜੀ ਦੇ ਅਯੋਧਿਆ ਦੇ ਅਯੋਧਿਆ ਜਦੋਂ ਵਾਪਸ ਆਏ ਸੀ ਉਸਦੇ ਦਿਵਸ ਦੇ ਵਿੱਚ ਵੀ ਰਾਮਲੀਲਾ ਮਨਾਈ ਜਾਂਦੀ ਹੈ ਨਵਰਾਤਰਿਆਂ ਦੇ ਵਿੱਚ ਵੱਡੇ ਹਨੁੰਮਾਨ ਦੇ ਮੰਦਰ ਅੰਮ੍ਰਿਤਸਰ ਦੇ ਵਿੱਚ ਲੰਗੂਰਾ ਦਾ ਮੇਲਾ ਲੱਗਦਾ ਬਹੁਤ ਹੀ ਤਾਦਾਦ ਦੇ ਵਿੱਚ ਉੱਥੇ ਸ਼ਰਧਾਲੂ ਪਹੁੰਚਦੇ ਹਨ ਇੰਨਾ ਜ਼ਿਆਦਾ ਰੋਣਕ ਹੁੰਦੀ ਹੈ ਕਿ ਉੱਥੇ ਤਾਂ ਆਪਣਾ ਬਹੁਤ ਹੀ ਆਨੰਦ ਆਉਂਦਾ ਹੈ ਬਹੁਤ ਹੀ ਅ ਆਪਣਾ ਮ ਮਹੱਤਵ ਹੈਗਾ ਹੈ ਨਵਰਾਤਰਿਆਂ ਦਾ ਦੇਵੀ ਦੁਰਗਾ ਮਾਤਾ ਦੇ ਵੀ ਬਹੁਤ ਜ਼ਿਆਦਾ ਉੱਥੇ ਪੂਜਾ ਕੀਤੀ ਜਾਂਦੀ ਹੈ ਦੁਰਗਾ ਮਾਤਾ ਦੇ ਸਾਕਸ਼ਾਤ ਅੱਠ ਦਿਨ ਦੇ ਅੱਠ ਨੌ ਦਿਨ ਵਾਸਤੇ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਖੇਤਰੀ ਲੋਕ ਬੀਜਦੇ ਹਨ ਓਸ ਉਹ ਦਿਨਾਂ ਦੇ ਵਿੱਚ ਅਤੇ ਉਸ ਤੋਂ ਬਾਅਦ ਅਸ਼ਟਮੀ ਨੂੰ ਕੰਜਕਾਂ ਦਿੱਤੀਆਂ ਜਾਂਦੀਆਂ ਹਨ ਕੰਜਕਾਂ ਤੋਂ ਬਾਅਦ ਆਪਣਾ ਦੁਸਹਿਰਾ ਮਨਾਇਆ ਜਾਂਦਾ ਹੈ ਦੁਸਹਿਰੇ ਦੇ ਵਿੱਚ ਰਾਵਣ ਨੂੰ ਜਦੋਂ ਰਾਵਣ ਨੇ ਸੀਤਾ ਮਈਆ ਰਾ ਰਾਮ ਚੰਦਰ ਜੀ ਨੇ ਰਾਵਣ ਦਾ ਉਹ ਆਪਾਂ ਕਰ ਦਿੱਤਾ ਸੀ ਸੰਘਾਰ ਉਸ ਤੋਂ ਬਾਅਦ ਉਹਦੇ ਅਵਸਰ ਦੇ ਵਿੱਚ ਰਾਮਲੀਲਾ ਮਨਾਈ ਜਾਂਦੀ ਹੈ ਨਵਰਾਤਰਾ ਮੇਲਾ ਮਨਾਇਆ ਜਾਂਦਾ ਪੰਜਾਬ ਦੇ ਤਾਂ ਇਹ ਬਹੁਤ ਹੀ ਬਹੁਤ ਜ਼ਿਆਦਾ ਸੱਭਿਆਚਾਰਕ ਸਮਾਗਮ ਹੈਗੇ ਹਨ ਅਤੇ ਇਹਦੇ ਵਿੱਚ ਸਾਨੂੰ ਅਸੀਂ ਖੁਸ਼ਨਸੀਬ ਹਾਂ ਕਿ ਸਾਨੂੰ ਇਹਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਦਾ ਹੈ